ਮੈਂ ਯੋਗਾ ਦੀ ਕਲਾਸ ਲਗਾਈ ਹੈ ਯੋਗਾ ਦੀ ਕਲਾਸ ਲਗਾਉਣ ਦਾ ਤਜਰਬਾ ਮੇਰਾ ਇਹ ਰਿਹਾ ਕਿ ਜਦੋਂ ਮੈਂ ਪਹਿਲਾਂ ਘਰ ਦੇ ਯੋਗਾ ਕਰਦਾ ਸੀ ਆਪਣੇ ਆਪ ਹੀ ਇੱਕ ਤਾਂ ਮੇਰਾ ਮਨ ਨਹੀਂ ਸੀ ਲੱਗਦਾ ਕਈ ਵਾਰ ਮੈਂ ਦਸ ਮਿੰਟ ਕਰਨਾ ਕਦੀ ਪੰਦਰਾਂ ਮਿੰਟ ਥੋੜ੍ਹਾ ਚਿਰ ਕਰਦਾ ਹਾਂ ਉਹਦੇ ਵਿੱਚ ਕੀ ਸੀ ਕਿ ਮੈਨੂੰ ਕਦੀ ਯਾਰ ਮੈਂ ਕੋਈ ਉਹਦਾ ਜਿਹੜਾ ਆਸਣ ਹੈ ਉਹ ਗਲਤ ਕਰ ਬੈਠਦਾ ਸੀ ਅਤੇ ਉਹਦੇ ਨਾਲ ਮੈਨੂੰ ਕੋਈ ਪ੍ਰੋਬਲਮ ਵੀ ਆ ਜਾਂਦੀ ਸੀ ਪਰ ਜਦੋਂ ਦੀ ਮੈਂ ਕਲਾਸ ਲਗਾਉਣ ਲੱਗਾ ਹਾਂ ਉਹਦੇ ਵਿੱਚ ਜੇ ਕਿਤੇ ਚੰਗੇ ਟ੍ਰੇਨਰ ਜਿਹੜੇ ਆ ਉਹ ਸਾਨੂੰ ਸਿਖਾਉਂਦੇ ਆ ਇੱਕ ਜ਼ਿਆਦਾ ਲੋਕ ਪੱਚੀ ਤੀਹ ਲੋਕ ਇਕੱਠੇ ਅਸੀਂ ਯੋਗਾ ਕਰਦੇ ਹਾਂ ਉਹਦੇ ਵਿੱਚ ਵੇਖ ਇੱਕ ਦੂਜੇ ਵੱਲ ਵੇਖ ਕੇ ਜਿਹੜਾ ਨਾ ਉਤਸ਼ਾਹ ਬਣਦਾ ਵਾ ਯੋਗਾ ਕਰਨ ਦਾ ਦੂਜਾ ਜਦੋਂ ਦਾ ਅਸੀਂ ਇਹਦੇ 'ਚ ਲੱਗੇ ਹਾਂ ਅਲੱਗ ਅਲੱਗ ਹੋਰ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਵਾ ਬਹੁਤ ਜ਼ਿਆਦਾ ਜਿਹੜਾ ਵਧੀਆ ਲੱਗਦਾ ਕਲਾਸ ਦੇ ਵਿੱਚ ਇੱਕ ਦੂਜੇ ਵੱਲ ਵੇਖ ਕੇ ਜਦੋਂ ਅਸੀਂ ਯੋਗੇ ਨੂੰ ਕਰਦੇ ਹਾਂ ਅਤੇ ਕਈ ਜਿਹੜੀਆਂ ਅਸੀਂ ਗਲਤੀਆਂ ਘਰ 'ਚ ਆਪ ਕਰਦੇ ਸੀ ਹੁਣ ਉਹ ਸਾਡੀਆਂ ਠੀਕ ਹੋ ਗਈਆਂ ਵਾ ਹੁਣ ਅਸੀਂ ਉਹਨੂੰ ਗਲਤ ਤਰੀਕੇ ਨਾਲ ਨਹੀਂ ਕਰਦੇ ਉਹਨੂੰ ਬਿਲਕੁਲ ਸਿੱਖ ਕੇ ਸਹੀ ਤਰੀਕੇ ਨਾਲ ਯੋਗਾ ਕਰਦੇ ਹਾਂ ਅਤੇ ਜਿਹੜਾ ਇਹਦਾ ਤਜਰਬਾ ਉਹ ਮੇਰਾ ਇੰਨਾ ਸ਼ਾਨਦਾਰ ਰਿਹਾ ਕਿ ਮੈਂ ਤਾਂ ਲੋਕਾਂ ਨੂੰ ਇਹ ਚਾਹੁੰਦਾ ਵੀ ਦੂਜੇ ਲੋਕਾਂ ਨੂੰ ਵੀ ਹੁਣ ਮੈਂ ਸਿਖਾਵਾਂ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਹੋ ਹੀ ਸਲਾਹ ਦੇਵਾਂ ਕਿ ਤੁਸੀਂ ਕਲਾਸ ਦੇ ਵਿੱਚ ਆਉਣ ਕੇ ਹੀ ਯੋਗਾ ਕਰੋ